ਹਾਂ ਮੈਂ ਇਹੋ ਜਿਹੀ ਚੀਜ਼ ਬਣਾਈ ਹੈਗੀ ਜਦ ਮੈਂ ਛੇਵੇਂ ਸੱਤਵੇਂ ਚ ਆਉਂਦਾ ਸੀਗਾ ਉਦੋਂ ਮੈਂ ਮੰਮੀ ਦਾ ਮਦਰਸ ਡੇ ਤੇ ਇੱਕ ਵਾਰੀ ਪੋਸਟਰ ਪੋਸਟਰ ਬਣਾਇਆ ਸੀਗਾ ਦਿਖਾਇਆ ਸੀਗਾ ਕਿ ਮੈਂ ਤੇਰਾ ਆਪਣੇ ਕੀ ਕੰਮ ਕਰਦੇ ਆਪਣੇ ਲਈ ਕਿੰਨਾ ਕੁਝ ਕਰਦੇ ਆ ਆਪਣੇ ਲਈ ਕੀ ਕੀ ਸਕਰੀਨਸ ਕਰਦੇ ਹੈਗੇ ਆ ਤੇ ਹੁਣ ਜਦੋਂ ਮੇਰੇ ਪੋਸਟਰ ਦੁਬਾਰਾ ਦੇ ਦਿੱਤਾ ਤਾਂ ਮੈਨੂੰ ਮਮੀ ਦੀ ਬਹੁਤ ਯਾਦ ਆਉਂਦੀ ਹੈਗੀ ਹ ਮੈਨੂੰ ਇਹ ਆਉਂਦਾ ਹੈਗਾ ਕ ਮਮੀ ਮੇਰੇ ਨਾਲ ਕਿਵੇਂ ਰਹਿੰਦੇ ਸੀਗੇ ਮੈਨੂੰ ਖਾਣ ਨੂੰ ਬਣਾ ਕੇ ਦਿੰਦੇ ਸੀਗੇ ਘਰ ਦਾ ਵੇਖ ਕੇ ਘਰ ਦਾ ਸਾਰਾ ਕੰਮ ਕਰਦੇ ਸੀਗੇ ਮੈਨੂੰ ਕਹਾਣੀਆਂ ਸੁਣਾਉਂਦੇ ਸੀਗੇ ਜਦੋਂ ਕੋਈ ਮੈਨੂੰ ਮੇਰਾ ਵੱਡਾ ਭਰਾ ਮੈਨੂੰ ਮਾਰਦਾ ਸੀ ਜਦੋਂ ਮੇਰਾ ਡੈਡੀ ਮੈਨੂੰ ਮਾਰ ਹੁੰਦਾ ਸੀਗਾ ਮੈਂ ਕੋਲੇ ਚਲਾ ਜਾਂਦਾ ਹੁੰਦਾ ਸੀਗਾ ਮੈਂ ਮਮੀ ਇਕੱਠੇ ਸੌਂਦੇ ਸੀਗੇ ਤੇ ਹੁਣ ਤੇ ਹੁਣ ਜਦੋਂ ਮੈਂ ਤੁਹਾਨੂੰ ਜਦੋਂ ਫਿਰ ਮੈਂ ਕੱਲਾ ਰਹਿ ਜਾਂਦਾ ਸੀਗਾ ਕਮਰੇ ਚ ਉਦੋਂ ਮੈਂ ਰਾਤ ਨੂੰ ਕਮਰੇ ਚ ਉਦੋਂ ਮੈਂ ਰਾਤ ਨੂੰ ਰੋ ਰੋ ਕੇ ਸੁਣਦਾ ਸੀਗਾ ਕੱਲਾ ਸੀਗਾ ਕਿਸੇ ਨੂੰ ਕੋਈ ਕਿਸੇ ਨੂੰ ਮੈਂ ਦੱਸਦਾ ਨਹੀਂ ਸੀਗਾ ਨਾ ਭਰਾ ਨੂੰ ਨਾ ਆਪਦੇ ਡੈਡੀ ਨੂੰ ਕਿਉਂਕਿ ਮਮੀ ਸੀਗੇ ਜਿਹਦੇ ਨਾਲ ਮੈਂ ਸਾਰਾ ਕੁਝ ਸ਼ੇਅਰ ਕਰਦਾ ਸੀ ਚਲੇ ਗਏ ਸੀਗੇ ਤਾਂ ਚਲੇ ਗਏ ਸੀਗੇ ਤਾਂ ਉਹ ਜਿਹੜੀ ਮੈਂ ਡਰਾਇੰਗ ਬਣਾਈ ਸੀ ਉਹ ਮੇਰੇ ਲਈ ਬਹੁਤ ਜਰੂਰੀ ਹੈਗੀ ਆ ਵੈਲੀ ਬਹੁਤ ਜਿਆਦਾ ਦਿਲ ਚ ਜਰੂਰੀ ਮੈਂ ਸਾਰਾ ਰੱਖਦੀ ਹ ਕਿਉਂਕਿ ਉਹਨੂੰ ਮੈਂ ਆਪਦੇ ਦਿਲ ਦੇ ਨੇੜੇ ਲਾ ਕੇ ਰੱਖਿਆ ਸੀਗਾ ਉਹ ਹੁਣ ਤੁਹਾਨੂੰ ਮੇਰੇ ਵਾਸਤੇ ਬਹੁਤ ਹੀ ਜਿਆਦਾ ਵਧੀਆ ਬਹੁਤ ਹੀ ਜਿਆਦਾ ਹੈਗੀ ਆ ਬਹੁਤ ਜਿਆਦਾ ਚੰਗੀ ਹੈਗੀ ਆ